ਫਤਿਹਗੜ੍ਹ ਸਾਹਿਬ ਦੀ ਧਰਤੀ ਸ਼ਹੀਦਾਂ ਦੀ ਧਰਤੀ ਦੇ ਨਾਂ ਨਾਲ ਜਾਣੀ ਜਾਂਦੀ ਹੈ ਇੱਥੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਦੁਨੀਆਂ ਦੀ ਸਭ ਤੋਂ ਮਹਿੰਗੀ ਜਗ੍ਹਾ ਹੈ ਜੋ ਜੋਤ ਟੋਡਰ ਮੱਲ ਜੀ ਨੇ ਸੋਨੇ ਦੀਆਂ ਮੋਹਰਾਂ ਰੱਖ ਕੇ ਖਰੀਦੀ ਸੀ ਇੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਸ਼ਹੀਦ ਹੋਏ ਹਨ ਫਤਿਹਗੜ੍ਹ ਸਾਹਿਬ ਜੀ ਦੇ ਵਿੱਚ ਕਾਫੀ ਗੁਰਦੁਆਰਾ ਸਾਹਿਬ ਹਨ ਜਿਵੇਂ ਕਿ ਗੁਰਦੁਆਰਾ ਫਤਿਹਗੜ੍ਹ ਸਾਹਿਬ ਗੁਰਦੁਆਰਾ ਸ਼ਹੀਦਗੰਜ ਸਾਹਿਬ ਗੁਰਦੁਆਰਾ ਠੰਡਾ ਬੁਰਜ ਸਾਹਿਬ ਗੁਰਦੁਆਰਾ ਬੀਬਾਨਗੜ੍ਹ ਸਾਹਿਬ ਇਹਨਾਂ ਤੋਂ ਇਲਾਵਾ ਇੱਥੇ ਇੱਕ ਮੁਸਲਮਾਨਾਂ ਦੇ ਟਾਈਮ ਦਾ ਸਮੇਂ ਦਾ ਆਮ ਖਾਸ ਬਾਗ ਵੀ ਹੈ ਜੋ ਕਿ ਬਹੁਤ ਮਸ਼ਹੂਰ ਹੈ ਜਿੱਥੇ ਸੈਲਾਨੀ ਦੂਰ ਦੂਰ ਤੋਂ ਇਸ ਨੂੰ ਦੇਖਣ ਲਈ ਆਉਂਦੇ ਹਨ ਅਤੇ ਮੁਸਲਿਮ ਧਰਮ ਦੇ ਨਾਲ ਸੰਬੰਧਿਤ ਰੋਜ਼ਾ ਸ਼ਰੀਫ ਮਸਜਿਦ ਵੀ ਇਸ ਸ਼ਹਿਰ ਦੇ ਵਿੱਚ ਹੀ ਹੈ ਇਸ ਸ਼ਹਿਰ ਦੇ ਵਿੱਚ ਹਰ ਸਾਲ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਲੱਖਾਂ ਹੀ ਲੋਕ ਆ ਕੇ ਗੁਰਦੁਆਰਾ ਸਾਹਿਬ ਢੁਕਦੇ ਹਨ ਅਤੇ ਆਪਣਾ ਪ੍ਰਣਾਮ ਜਿਹੜਾ ਹੈ ਉਹ ਕਰਦੇ ਹਨ ਸ਼ਹੀਦਾਂ ਨੂੰ ਅਤੇ ਬਹੁਤ ਹੀ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਆ ਕੇ ਇੱਥੇ ਲੰਗਰ ਲਗਾਉਂਦੀਆਂ ਹਨ ਜਿਹੜਾ ਕਿ ਦਸ ਤੋਂ ਪੰਦਰ੍ਹਾਂ ਦਿਨ ਤੱਕ ਚੱਲਦਾ ਹੈ ਇਸ ਤੋਂ ਇਲਾਵਾ ਫਤਿਹਗੜ੍ਹ ਸਾਹਿਬ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕੋਲਜ ਹੈ ਜੋ ਕਿ ਬਹੁਤ ਹੀ ਪੁਰਾਣਾ ਇੰਜੀਨੀਅਰਿੰਗ ਕੋਲਜ ਹੈ ਅਤੇ ਮਾਤਾ ਗੁਜਰੀ ਕੋਲਜ ਹੈ ਅਤੇ ਬਾਬਾ ਸਿੱਖ ਵਰਡ ਯੂਨੀਵਰਸਿਟੀ ਵੀ ਇਸ ਸ਼ਹਿਰ ਦੇ ਵਿੱਚ ਹੀ ਹੈ ਅਤੇ ਇਹ ਤਿੰਨੋ ਅਦਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਚਲਾਏ ਜਾਂਦੇ ਹਨ ਅਤੇ ਫਤਿਹਗੜ੍ਹ ਸਾਹਿਬ ਦੀ ਜਿਹੜੀ ਧਰਤੀ ਹੈ ਬਹੁਤ ਹੀ ਪਵਿੱਤਰ ਧਰਤੀ ਹੈ ਜਿੱਥੇ ਛੋਟੇ ਛੋਟੇ ਸਾਹਿਬਜ਼ਾਦਿਆਂ ਦਾ ਖੂਨ ਜਿਹੜਾ ਹੈ ਡੁੱਲਿਆ ਹੋਇਆ ਹੈ ਅਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਫਤਿਹਗੜ੍ਹ ਸਾਹਿਬ ਦੀ ਧਰਤੀ ਉੱਤੇ ਜਿੱਤ ਪ੍ਰਾਪਤ ਕਰਕੇ ਇੱਥੇ ਸਿੱਖੀ ਰਾਜ ਦੀ ਜਿਹੜੀ ਹੈ ਨੀਂਹ ਰੱਖੀ ਸੀ ਧੰਨਵਾਦ